ਹੈਲੋ ਹਾਂਜੀ ਹਾਂਜੀ ਦੱਸੋ ਜੀ ਹਾਂਜੀ ਹੈੱਡ ਹਾਂਜੀ ਹਾਂਜੀ ਹੈਡ ਸਟਾਫ ਬੋਲ ਰਹੀ ਜੀ ਦੱਸੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੈਡ ਚਰਜਿਸ ਵੱਧ ਲਾਏ ਦਵਾਈਆਂ ਇਦਾਂ ਦਾ ਇਸ਼ੂ ਨਹੀਂ ਪਹਿਲਾਂ ਕਦੀ ਹੋਇਆ ਜੀ ਤੁਸੀਂ ਕਹਿ ਰਹੇ ਹੋ ਚਲੋ ਦੇਖਦੇ ਹਾਂ ਨਹੀਂ ਨਹੀਂ ਇਹ ਤਾਂ ਨਹੀਂ ਹੋ ਸਕਦਾ ਇਹ ਤਾਂ ਫਿਰ ਪੂਰੇ ਡਿਪਾਰਟਮੈਂਟ ਦਾ ਇੰਨਸਲਟ ਹੁੰਦੀ ਇਸ ਗੱਲ 'ਚ ਕੋਈ ਗੱਲ ਨਹੀਂ ਆਪਾਂ ਤੁਹਾਡੇ ਬਿੱਲ ਚੈੱਕ ਕਰਵਾ ਲਵਾਂਗੀ ਕਿੰਨਾ ਚਾਰਜਿਸ ਬਣਦਾ ਤੁਹਾਡੇ ਤੋਂ ਕਿੰਨਾ ਲਿਆ ਗਿਆ ਕੀ ਪ੍ਰੋਬਲਮ ਆ ਕੀ ਇਸ਼ੂ ਆ ਉਹ ਆਪਾਂ ਵੈਰੀ ਕਰਵਾ ਕੇ ਤੁਹਾਡੀ ਕੰਪਲੇਂਟ ਫੋਲੋ ਕਰਵਾ ਦੇਵਾਂਗੇ ਉਹ ਤਾਂ ਕੋਈ ਵੱਡਾ ਇਸ਼ੂ ਨਹੀਂ ਹੈ ਹਾਂਜੀ ਨਹੀਂ ਨਹੀਂ ਹੈ ਨਹੀਂ ਹੁੰਦਾ ਜੀ ਉਹ ਤਾਂ ਕੋਈ ਗੱਲ ਨਹੀਂ ਹਾਂਜੀ ਮੇਰਾ ਨਾਮ ਮਨਪ੍ਰੀਤ ਹੈ ਜੀ ਹਾਂਜੀ ਅਸੀਂ ਹੋਸਪਿਟਲ 'ਚ ਹੀ ਮਿਲਾਂਗੇ ਜੀ ਤੁਸੀਂ ਹੋਸਪਿਟਲ ਆ ਕੇ ਆਪਣੇ ਸਾਰੇ ਬਿੱਲ ਤੁਹਾਨੂੰ ਜਿਹੜੇ ਲੱਗਦੇ ਆ ਬਈ ਚਾਰਜਿਸ ਜ਼ਿਆਦਾ ਲੱਗੇ ਉਹ ਸਾਰੇ ਲੈ ਆਇਓ ਹੋ ਪੂਰੀ ਡਿਟੇਲ ਆਪਾਂ ਚੈੱਕ ਕਰਕੇ ਉਹ ਦੇਖ ਲਵਾਂਗੇ ਕੀ ਪ੍ਰੋਬਲਮ ਆ ਕੀ ਤੁਹਾਡੀ ਉਹਦੀ ਫਿਰ ਆਪਾਂ ਫੋਲੋ ਕਰਵਾ ਕੇ ਤੁਸੀਂ ਨੌਂ ਤੋਂ ਪੰਜ ਕਿਸੇ ਵੀ ਦਿਨ ਆ ਸਕਦੇ ਹੋ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਆ